ਮੈਂ ਦਸ ਦਿਨ ਪਹਿਲਾਂ ਫਲਿਪਕਾਰਡ ਤੋਂ ਔਡਰ ਕਰਿਆ ਤਾ ਪਰਫਿਊਮ ਕੱਲ੍ਹ ਮੈਂ ਉਹਨੂੰ ਰਿਸੀਵ ਕਰਿਆ ਅਤੇ ਜਦ ਮੈਂ ਰਿਸੀਵ ਕਰਿਆ ਉਹਨੂੰ ਬਾਹਰ ਤੋਂ ਉਹਦੀ ਪੈਕਿੰਗ ਐਨੀ ਬੇਕਾਰ ਸੀ ਮਤਲਬ ਜਦ ਮੈਂ ਓਪਨ ਕਰਿਆ ਪੈਕਿੰਗ ਵੀ ਉਹਦੀ ਵਧੀਆ ਨਹੀਂ ਸੀ ਜਦ ਓਪਨ ਕਰਿਆ ਔਰ ਢੱਕਣ ਇੱਕ ਦਾ ਹੈ ਤਾਂ ਅਤੇ ਜਿਹੜਾ ਟੁੱਟਿਆ ਵਾ ਤਾ ਇੱਕ ਦਾ ਢੱਕਣ ਹੈ ਹੀ ਨਹੀਂ ਤਾ ਅਤੇ ਜਦ ਉਹਦੀ ਪੈਕਿੰਗ ਹੀ ਵਧੀਆ ਨਹੀਂ ਸੀ ਅਤੇ ਉਹਦੇ ਅੰਦਰ ਮਤਲਬ ਢੱਕਣ ਵੀ ਟੁੱਟਿਆ ਵਾ ਤਾ ਤਿੰਨ ਉਹਦੇ 'ਚ ਸੀਗੇ ਅਤੇ ਉਹ ਮਤਲਬ ਉਹਦੀ ਕੁਆਲਿਟੀ ਵੀ ਵਧੀਆ ਨਹੀਂ ਸੀ ਅਤੇ ਜਿਹੜੀ ਚੀਜ਼ ਮੈਂ ਮੰਗਵਾਈ ਤੀ ਉਹ ਚੀਜ਼ ਹੈ ਨਹੀਂ ਤਾ ਦੇਸੀ ਚੀਜ਼ ਆਇਆ ਮਤਲਬ ਮੈਨੂੰ ਜਿਹੜਾ ਚੀਜ਼ ਚਾਹੀਦਾ ਤਾ ਉਹ ਨਹੀਂ ਤਾ ਫਲਿਪਕਾਰਡ ਤੋਂ ਮੈਂ ਕਈ ਵਾਰੀ ਮਤਲਬ ਸਮਾਨ ਔਡਰ ਕਰਵਾਉਂਦੀ ਹਾਂ ਬਟ ਪਹਿਲੀ ਵਾਰ ਮੈਨੂੰ ਇੱਦਾਂ ਦਾ ਸਮਾਨ ਮਿਲਿਆ ਅਤੇ ਮੈਨੂੰ ਬਹੁਤ ਨਿਰਾਸ਼ਾ ਹੈ ਕਿ ਮੈਨੂੰ ਇੱਦਾਂ ਸਮਾਨ ਮਿਲਿਆ ਮੈਂ ਹਰੇਕ ਵਾਰੀ ਔਡਰ ਕਰਾ ਕੇ ਮੰਗਵਾਉਂਦੀ ਹਾਂ ਸਮਾਨ ਮੈਨੂੰ ਬਿਲਕੁਲ ਵੀ ਨਹੀਂ ਪਸੰਦ ਆਇਆ ਧੰਨਵਾਦ